ਸਿੱਖ ਧਰਮ ਤਰਨਤਾਰਨ ਵਿੱਚ ਇੱਕ ਪ੍ਰਮੁੱਖ ਧਰਮ ਹੈ ਸਿੱਖ ਧਰਮ ਦੀ ਮੂਲ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਤ ਹੈ ਜੋ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਦੇ ਉਪਦੇਸ਼ਾਂ ਤੋਂ ਬ ਲਿਖੀ ਗਈ ਹੈ ਸਿੱਖ ਧਰਮ ਵਿੱਚ ਇੱਕ ਪ੍ਰਮਾਤਮਾ ਦਾ ਮਾਣਨਾ ਜਿੰਦਗੀ ਜੀਣਾ ਅਤੇ ਸਮਾਜਿਕ ਸੇਵਾ ਦੀ ਪ੍ਰਵੀਨਤਾ ਦੀ ਪ੍ਰੇਰਣਾ ਦਿੱਤੀ ਗਈ ਹੈ ਸਿੱਖ ਧਰਮ ਵਿੱਚ ਭਾਈਚਾਰਾ ਸਮਾਜਿਕ ਨਿਯਮ ਅਤੇ ਸਹਾਇਤਾ ਦੀ ਪ੍ਰਵੀਨਤਾ ਨੂੰ ਬੜੀ ਵਿਸ਼ੇਸ਼ਤਾ ਦਿੱਤੀ ਗਈ ਹੈ ਇਸ ਧਰਮ ਵਿੱਚ ਸਿੱਖ ਸੰਤਾਂ ਅਤੇ ਸੇਵਾਦਾਰਾਂ ਨੇ ਇਨਸਾਨੀਅਤ ਅਤੇ ਮਾਨਵਤਾ ਦੇ ਲਈ ਕੰਮ ਕੀਤਾ ਹੈ